ਨੌਂ ਲੱਖ ਨੱਬੇ ਹਜ਼ਾਰ ਨੌਂ ਸੌ ਨੱਬੇ ਸੱਤ ਲੱਖ ਸਤੱਤਰ ਹਜ਼ਾਰ ਪੰਜ ਸੌ ਨੌਂ ਚਾਰ ਹਜ਼ਾਰ ਅੱਠ ਸੌ ਬਾਰ੍ਹਾਂ ਪੰਜ ਲੱਖ ਤੀਹ ਹਜ਼ਾਰ ਨੌਂ ਸੌ ਨੌਂ ਲੱਖ ਚਾਰ ਹਜ਼ਾਰ ਦੋ ਸੌ ਇੱਕ